ਜਿਵੇਂ ਕਿ ਤੁਹਾਨੂੰ ਪਤਾ ਵੀ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਕਈ ਵਾਰ ਇਨਸਾਨ ਤੋਂ ਕੋਈ ਇਹੋ ਜਿਹੀ ਗਲਤੀ ਹੋ ਜਾਂਦੀ ਹੈ ਜੋ ਜੀਵਨ ਭਰ ਵਿੱਚ ਉਸਦਾ ਸਾਥ ਨਹੀਂ ਛੱਡਦੀ ਅਤੇ ਉਸ ਗਲਤੀ ਦਾ ਪਛਤਾਵਾ ਇਸ ਇਨਸਾਨ ਨੂੰ ਸਾਰੀ ਜ਼ਿੰਦਗੀ ਰਹਿੰਦਾ ਹੈ ਇੱਦਾਂ ਦੀ ਹੀ ਗਲਤੀਆਂ ਕੁਛ ਮੇਤੋਂ ਵੀ ਹੋਈਆਂ ਨੇ ਪਰ ਉਹਨਾਂ ਦੇ ਵਿੱਚੋਂ ਜ਼ਿਆਦਾ ਮੇਨ ਇਹ ਸੀ ਵੀ ਮੈਂ ਪੜ੍ਹ ਨਹੀਂ ਸਕਿਆ ਪੜ੍ਹਨ ਵਾਲੀ ਗਲਤੀ ਮੈਨੂੰ ਹੁਣ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਆ ਵੀ ਜੇ ਮੈਂ ਜ਼ਿੰਦਗੀ ਵਿੱਚ ਪੜ੍ਹ ਲੈਂਦਾ ਕੁਛ ਥੋੜ੍ਹਾ ਜਿਹਾ ਹੋਰ ਅੱਗੇ ਸਟੱਡੀ ਪੜ੍ਹਾਈ ਕਰ ਲੈਂਦਾ ਤਾਂ ਸ਼ਾਇਦ ਅੱਜ ਮੇਰਾ ਭਵਿੱਖ ਕੁਛ ਹੋਰ ਹੁੰਦਾ ਵੀ ਮੈਂ ਪਲੱਸ ਟੂ ਤੋਂ ਬਾਅਦ ਟਰਾਈ ਨਹੀਂ ਕਰੀ ਬੀਏ ਕਰਨ ਦੀ ਜਾਂ ਕੋਈ ਹੋਰ ਸਟੱਡੀ ਕੋਈ ਕੋਰਸ ਕਰ ਲੈਂਦਾ ਜਿਹਦੇ ਨਾਲ ਵੈਲਿਊਵਲ ਕੋਰਸ ਹੁੰਦਾ ਵੀ ਚਲੋ ਕੋਈ ਬੰਦਾ ਸਰਕਾਰੀ ਨੌਕਰੀ ਵਾਲੇ ਪਾਸੇ ਨੂੰ ਹੋ ਜਾਂਦਾ ਅਤੇ ਅੱਜ ਉਹ ਉਸ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਆ ਕਿਉਂਕਿ ਪੜ੍ਹਾਈ ਨਾਲ ਹੀ ਬੰਦੇ ਦਾ ਜੀਵਨ ਅਤੇ ਉਸਦੇ ਸੁਪਨੇ ਪੂਰੇ ਹੁੰਦੇ ਹਨ ਜੇ ਤੁਸੀਂ ਸੋਚਦੇ ਹੋ ਵੀ ਹਾਂ ਚਲੋ ਕੋਈ ਨਹੀਂ ਬਾਰ੍ਹਾਂ ਕਰਲੀਆਂ ਕੋਈ ਗੱਲ ਨਹੀਂ ਸਰ ਜੂਗਾ ਇਹ ਨਹੀਂ ਹੁੰਦਾ ਪੜ੍ਹਾਈ ਜਿੰਨੀ ਹੋ ਸਕੇ ਵੱਧੋ ਵੱਧ ਕਰਨੀ ਚਾਹੀਦੀ ਆ ਮੇਰੀ ਸਭ ਤੋਂ ਵੱਡੀ ਗਲਤੀ ਇਹੀ ਆ ਵੀ ਮੈਂ ਬਾਰ੍ਹਾਂ ਤੋਂ ਬਾਅਦ ਅੱਗੇ ਪੜ੍ਹ ਏ ਨਹੀਂ ਸਕਿਆ ਮੈਨੂੰ ਮੌਕਾ ਮਿਲਿਆ ਪਰ ਉਹ ਮੌਕਾ ਮੈਂ ਗਵਾ ਚੁੱਕਿਆ ਮੇਰੇ ਮਾਂ ਬਾਪ ਨੇ ਕੋਸ਼ਿਸ਼ ਕਰੀ ਸੀ ਵੀ ਚਲੋ ਪੜ੍ਹਾ ਦਈਏ ਬੱਚੇ ਨੂੰ ਪਰ ਮੈਂ ਆਪਣੀਆਂ ਅਣਗਹਿਲੀਆਂ ਕਰਕੇ ਆਪਣੀਆਂ ਬੱਸ ਮਜਬੂਰੀਆਂ ਘਰੇਲੂ ਸ਼ੁਰੂ ਤੋਂ ਹੀ ਬਸ ਕੰਮਾਂ ਕਾਰਾਂ ਦੇ ਵਿੱਚ ਫਸ ਗਏ ਅਤੇ ਅੱਗੇ ਪੜ੍ਹਾਈ ਨਹੀਂ ਹੋ ਸਕੀ ਮੇਰੇ ਨਾਲ ਦੇ ਸੱਜਣ ਮਿੱਤਰ ਆ ਜਿਹੜੇ ਪੜ੍ਹੇ ਆ ਚਲੋ ਅੱਗੇ ਵਧੀਆ ਜੋਬਾਂ 'ਤੇ ਲੱਗੇ ਵੇ ਨੇ ਪਰ ਹੁਣ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਆਪਣੇ ਬੱਚਿਆਂ ਨੂੰ ਵੱਧੋ ਵੱਧ ਪੜ੍ਹਾਵਾਂ ਬੇਟਾ ਮੇਰਾ ਬਾਰ੍ਹਵੀਂ ਹੈ ਗੁੜੀਆ ਪੰਜਵੀਂ 'ਚ ਹੋ ਗਈ ਪਰ ਇਹ ਆ ਵੀ ਬ ਇਨਸਾਨ ਨੂੰ ਜੇ ਕੋਈ ਗਲਤੀ ਕਰਦਾ ਹੈ ਤਾਂ ਉਹਨੂੰ ਉਸ ਟਾਇਮ ਦਾ ਮੌਕਾ ਦੇ ਹਿਸਾਬ ਨਾਲ ਉਹਨੂੰ ਸੁਧਾਰ ਲੈਣਾ ਚਾਹੀਦਾ ਹੈ ਮੇਰੀ ਇਹੀ ਸਭ ਤੋਂ ਵੱਡੀ ਗਲਤੀ ਸੀ ਵੀ ਮੈਂ ਪੜ੍ਹਾਈ ਨਹੀਂ ਕਰ ਸਕਿਆ ਜੇ ਪੜ੍ਹਾਈ ਕਰੀ ਹੁੰਦੀ ਤਾਂ ਅੱਜ ਮੇਰਾ ਜੀਵਨ ਕੁਛ ਹੋਰ ਹੁੰਦਾ